ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਪੰਜਾਬ ਦੇ ਗੁਰਦਾਸਪੁਰ ਪਾਸੇ ਵਿੱਚ ਕਈ ਤਰ੍ਹਾਂ ਦੇ ਪੰਛੀ ਵੇਖੇ ਜਾਂਦੇ ਹਨ ਜੋ ਕਿ ਹਨ ਚਿੜੀਆਂ ਕਬੂਤਰ ਕਾਂ ਮੋਰ ਕਊਏ ਕੋਇਲਾਂ ਅਤੇ ਤੋਤੇ ਮੈਨੂੰ ਕਾਫ਼ੀ ਪੰਛੀ ਪਸੰਦ ਹਨ ਲੇਕਿਨ ਕਬੂਤਰ ਤੋਤੇ ਅਤੇ ਮੋਰ ਕੁਛ ਜ਼ਿਆਦਾ ਹੀ ਸੋਹਣੇ ਲੱਗਦੇ ਹਨ ਮੈਂ ਜਦੋਂ ਵੀ ਕਬੂਤਰ ਅਤੇ ਮੋਰ ਅਤੇ ਤੋਤਿਆਂ ਨੂੰ ਵੇਖਦਾ ਹਾਂ ਮੈਂ ਬਸ ਉਹਨਾਂ ਨੂੰ ਹੀ ਵੇਖਦਾ ਹਾਂ ਕਿ ਉਹ ਕਿੰਨੇ ਸੁੰਦਰ ਲੱਗ ਰਹੇ ਹੈ ਖੁਦ ਦਾ ਹੀ ਆਪਣੇ ਆਪ ਨੂੰ ਸਾਫ਼ ਕਰਦੇ ਕੁਛ ਖਾਂਦੇ ਪਾਣੀ ਪੀਂਦੇ ਅਤੇ ਉਸ ਤੋਂ ਇਲਾਵਾ ਮੇਰੇ ਦੋਸਤ ਨੇ ਵੀ ਕਬੂਤਰ ਪਾਲੇ ਹੋਏ ਹਨ ਜੋ ਕਿ ਬਹੁਤ ਹੀ ਸੁੰਦਰ ਲੱਗਦੇ ਹਨ ਹਾਂ ਮੈਂ ਖੁਦ ਵੀ ਕਬੂਤਰਾਂ ਦੇ ਲਈ ਆਪਣੀ ਛੱਤ 'ਤੇ ਦਾਣਾ ਅਤੇ ਪਾਣੀ ਰੱਖਦਾ ਹਾਂ ਜੋ ਕਿ ਉਹ ਖੁਦ ਆ ਕੇ ਪੀਂਦੇ ਹਨ ਅਤੇ ਉਹਨਾਂ ਨੂੰ ਦੇਖਦੇ ਹੋਏ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਕਿੰਨੇ ਸਾਡੀ ਜਿਹੜੀ ਕੁਦਰਤ ਹੈ ਉਹਨਾਂ ਨੇ ਕਿੰਨੇ ਸੋਹਣੇ ਸੋਹਣੇ ਬਣਾਏ ਹਨ ਕਬੂਤਰ ਵਗੈਰਾ